ਰੂਪਨਗਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਵਿਕਲਪ ਸੜਕਾਂ ਅਤੇ ਰੇਲਵੇ ਹਨ ਦੇਖਿਆ ਜਾਵੇ ਤਾਂ ਰੇਲਵੇ ਵਿੱਚ ਅਸੀਂ ਆਰਾਮਦਾਇਕ ਸਫ਼ਰ ਕਰ ਸਕਦੇ ਹਾਂ ਅਤੇ ਇਸ ਵਿੱਚ ਖਰਚਾ ਵੀ ਘੱਟ ਹੁੰਦਾ ਹੈ ਇਹ ਸਸਤਾ ਹੁੰਦਾ ਹੈ ਪਰ ਬੱਸਾਂ ਵਿੱਚ ਅਸੀਂ ਆਰਾਮਦਾਇਕ ਸਫ਼ਰ ਨਹੀਂ ਕਰ ਸਕਦੇ ਅਤੇ ਇਸਦਾ ਖਰਚਾ ਵੀ ਜ਼ਿਆਦਾ ਹੁੰਦਾ ਹੈ ਅਤੇ ਬੱਸਾਂ ਰੁੱਕ ਰੁੱਕ ਕੇ ਚੱਲਦੀਆਂ ਹਨ ਜਿਸ ਜਿਸ ਕਾਰਨ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਜਦ ਜਦੋਂ ਕਿ ਅਸੀਂ ਪਿਛਲੇ ਹੀ ਮਹੀਨੇ ਅੰਮ੍ਰਿਤਸਰ ਜਾ ਕੇ ਆਏ ਹਾਂ ਤਾਂ ਬੱਸਾਂ ਉਸ ਵਿੱਚ ਬੱਸ ਬੱਸ ਦਾ ਕਿਰਾਇਆ ਦੋ ਸੌ ਚਾਲ਼ੀ ਰੁਪਏ ਤੱਕ ਦਾ ਸੀ ਅਤੇ ਰੇਲਵੇ ਦਾ ਨੱਬੇ ਰੁਪਏ ਤੱਕ ਦਾ ਸੀ